ਪੁਰਾਣੇ ਸਮੇਂ ਵਿੱਚ ਬਾਜ਼ਾਰਾਂ ਵਿੱਚ ਬੜੀ ਭੀੜ ਹੁੰਦੀ ਸੀ ਜਿਸ ਤਰ੍ਹਾਂ ਸਾਡੇ ਨਵਾਸ਼ਹਿਰ ਜ਼ਿਲ੍ਹੇ ਵਿੱਚ ਹੀ ਕਾਫ਼ੀ ਜ਼ਿਆਦਾ ਮੰਡੀਆਂ ਵਿੱਚ ਭੀੜ ਮਿਲਦੀ ਹੈਗੀ ਅਤੇ ਲੋਕ ਆਪਣਾ ਸਮਾਨ ਆਪ ਦੇਖ ਕੇ ਸਾਹਮਣੇ ਖ਼ਰੀਦਦੇ ਸੀ ਜਦੋਂ ਦੀ ਔਨਲਾਈਨ ਸਰਵਿਸ ਸ਼ੁਰੂ ਹੋਈ ਹੈ ਉਹਦੇ ਨਾਲ਼ ਬਹੁਤ ਹੀ ਦਿੱਕਤ ਹੋਣੀ ਸ਼ੁਰੂ ਹੋ ਗਈ ਹੈ ਟਾਇਮ ਤਾਂ ਬੱਚਦਾ ਹੈ ਪਰ ਸਮਾਨ ਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਸਮਾਨ ਵਧੀਆ ਮਿਲੇ ਜਾਂ ਘਟੀਆ ਆ ਜਾਏ ਵਿੱਚ ਕਈ ਵਾਰੀ ਸਮਾਨ ਕੁਝ ਹੋਰ ਦੱਸਿਆ ਹੁੰਦਾ ਵਿੱਚ ਕੁਝ ਹੋਰ ਆ ਜਾਂਦਾ ਹੈ ਅਤੇ ਉਹਦੇ ਨਾਲ਼ ਬੰਦੇ ਨੂੰ ਟਾਇਮ ਵੇਸਟ ਵੀ ਹੁੰਦਾ ਹੈ ਜੇ ਔਨਲਾਈਨ ਸਾਹਮਣੇ ਜਾ ਕੇ ਖ਼ਰੀਦਦਾ ਹੈਗਾ ਬਾਜ਼ਾਰ ਵਿੱਚੋਂ ਤਾਂ ਸਮਾਨ ਵਧੀਆ ਦੇਖ ਕੇ ਆਪਣੀ ਮਨਪਸੰਦ ਦਾ ਚੀਜ਼ ਖ਼ਰੀਦ ਲੈਂਦਾ ਸੀ ਪਰ ਹੁਣ ਅੱਜ ਕੱਲ਼੍ਹ ਬਜਾਰ ਔਨਲਾਈਨ ਹੋਣ ਕਰਕੇ ਪਾਰਸਲ ਦੇ ਵਿੱਚ ਆਉਂਦਾ ਹੈ ਸਮਾਨ ਪਾਰਸਲ ਬੰਦਾ ਲੈ ਕੇ ਰੱਖ ਲੈਂਦਾ ਹੈ ਬਾਅਦ ਵਿੱਚ ਖੋਲ੍ਹ ਕੇ ਦੇਖਦਾ ਹੈ ਵੀ ਜੇ ਵਧੀਆ ਨਿਕਲ ਜਾਵੇ ਤਾਂ ਠੀਕ ਹੈ ਨਹੀਂ ਫਿਰ ਵਾਪਸ ਕਰਨ ਵਾਸਤੇ ਫਿਰ ਦੁਬਾਰਾ ਟਾਇਮ ਵੇਸਟ ਹੁੰਦਾ ਹੈ ਔਨਲਾਈਨ ਡਿਲੀਵਰੀ ਕਰਨੀ ਪੈਂਦੀ ਹੈ ਵਾਪਸ ਦੇਣੀ ਭੇਜਣੀ ਪੈਂਦੀ ਹੈ ਅਤੇ ਉਹਦੇ ਨਾਲ਼ ਟਾਈਮ ਤਾਂ ਵੇਸਟ ਹੁੰਦਾ ਹੀ ਹੈ ਜੇ ਬੰਦੇ ਨੇ ਕਿਤੇ ਜਾਣਾ ਹੋਵੇ ਕੋਈ ਜ਼ਰੂਰੀ ਕੰਮ 'ਤੇ ਜਾਂ ਕੋਈ ਗੱਲਬਾਤ ਹੋਵੇ ਫਿਰ ਉਹ ਬੰਦੇ ਨੂੰ ਮਿਸ ਕਰਨਾ ਪੈਂਦਾ ਉਸ ਦੀ ਵਜ੍ਹਾ ਨਾਲ਼ ਪ੍ਰੋਬਲਮ ਆਉਂਦੀ ਹੈ ਅਤੇ ਇਹਦੇ ਨਾਲ਼ੋ ਤਾਂ ਪੁਰਾਣੇ ਬਾਜ਼ਾਰ ਹੀ ਠੀਕ ਸੀਗੇ ਕਈ ਸਬਜ਼ੀ ਲੈਣੀ ਹੈ ਚਾਹੇ ਕੋਈ ਕੱਪੜਾ ਖ਼ਰੀਦਣਾ ਹੈ ਤਾਂ ਸਾਹਮਣੇ ਦੇਖ ਕੇ ਤਾਂ ਬੰਦਾ ਖ਼ਰੀਦ ਲੈਂਦਾ ਸੀਗਾ ਪਰ ਹੁਣ ਔਨਲਾਈਨ ਅੱਜ ਕੱਲ੍ਹ ਸਬਜ਼ੀ ਵੀ ਔਨਲਾਈਨ ਆਉਣ ਲੱਗ ਪਈ ਹੈ ਫ਼ਰੂਟ ਵੀ ਔਨਲਾਈਨ ਮਿਲਣ ਲੱਗ ਪਿਆ ਹੈ ਔਡਰ ਕਰਦੋ ਪੀਜ਼ਾ ਬਰਗਰ ਸਭ ਕੁਛ ਔਨਲਾਈਨ ਆ ਜਾਂਦਾ ਹੈ ਪਰ ਸਾਨੂੰ ਇਹ ਨੀ ਪਤਾ ਹੁੰਦਾ ਕਿ ਬਾਜ਼ਾਰ ਵਿੱਚ ਉਹ ਕਿਸ ਤਰ੍ਹਾਂ ਬਣੀ ਹੈ ਕਿਸ ਤਰ੍ਹਾਂ ਨਹੀਂ ਬਣੀ ਹੈ ਜਿਹੜੀ ਅਸੀਂ ਸਾਹਮਣੇ ਦੇਖ ਕੇ ਬਣਾਉਣੀ ਹੈ ਲੈਣੀ ਹੈ ਚੀਜ਼ ਉਹ ਵਧੀਆ ਹੁੰਦੀ ਸੀਗੀ ਜਿਹੜੀ ਅੱਜ ਕੱਲ੍ਹ ਕਈ ਵਾਰ ਔਨਲਾਈਨ ਮੰਗਾਉਂਦੇ ਹਾਂ ਉਹਦੀ ਸਾਨੂੰ ਕੋਈ ਗਰੰਟੀ ਨਹੀਂ ਹੁੰਦੀ ਕਿ ਕਿਸ ਤਰ੍ਹਾਂ ਬਣ ਕੇ ਆਈ ਹੈ ਕਿਸ ਤਰ੍ਹਾਂ ਸਾਫ਼ ਸਫ਼ਾਈ ਹੈ ਉਸ ਦੀ ਕਿਸ ਤਰ੍ਹਾਂ ਨਹੀਂ ਹੈ